ਸਾਡੇ ਘਰ ਵਿੱਚ ਆਮ ਤੌਰ 'ਤੇ ਚੌਵੀ ਘੰਟੇ ਹੀ ਬਿਜਲੀ ਆਉਂਦੀ ਹੈ ਪਰ ਕਈ ਵਾਰ ਮੌਸਮ ਦੀ ਖਰਾਬੀ ਕਰਕੇ ਬਿਜਲੀ ਦੇ ਕੱਟ ਲੱਗਦੇ ਰਹਿੰਦੇ ਹਨ ਜਿਵੇਂ ਕਿ ਹੁਣ ਮੌਨਸੂਨ ਦੇ ਵਿੱਚ ਬਿਜਲੀ ਨੇ ਸਾਨੂੰ ਕਾਫੀ ਤੰਗ ਕੀਤਾ ਪਰ ਟਾਈਮ ਰਹਿੰਦੇ ਉਸਦੀ ਮੁਰੰਮਤ ਵੀ ਕੀਤੀ ਕੀਤੀ ਗਈ ਇਸ ਬਿਜਲੀ ਦੇ ਕੱਟ ਕਾਰਨ ਸਾਡੀ ਜ਼ਿੰਦਗੀ ਵੀ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਪ੍ਰਭਾਵਿਤ ਕੀਤਾ ਕਿਉਂਕਿ ਅੱਜ ਦੇ ਟਾਈਮ ਵਿੱਚ ਬਿਜਲੀ ਨਾਲ਼ ਹੀ ਸਾਰਾ ਕੰਮ ਕੀਤਾ ਜਾਂਦਾ ਹੈ ਕੱਪੜੇ ਧੋਣ ਤੋਂ ਲੈ ਕੇ ਕੱਪੜੇ ਪ੍ਰੈੱਸ ਤੱਕ ਸਭ ਕੁਛ ਬਿਜਲੀ 'ਤੇ ਹੀ ਨਿਰਭਰ ਹੁੰਦਾ ਹੈ ਇੱਥੇ ਤੱਕ ਕਿ ਕਈ ਘਰਾਂ ਵਿੱਚ ਤਾਂ ਖਾਣਾ ਵੀ ਬਿਜਲੀ 'ਤੇ ਹੀ ਬਣਦਾ ਸੀ ਇ ਜਿਸ ਕਰਕੇ ਜੇਕਰ ਬਿਜਲੀ ਚਲੇ ਜਾਂਦੀ ਸੀ ਤਾਂ ਸਾਡੇ ਆਮ ਜ਼ਿੰ ਆਮ ਜ਼ਿੰਦਗੀ ਵਿੱਚ ਹੋ ਰਹੇ ਕੰਮਾਂ ਵਿੱਚ ਬਹੁਤ ਰੁਕਾਵਟ ਆਉਂਦੀ ਹੈ ਪਰ ਇਸ ਸਾਲ ਬਿਜਲੀ ਦੇ ਕੱਟਾਂ ਨੇ ਬਹੁਤ ਹੀ ਘੱਟ ਸਾਨੂੰ ਤੰਗ ਕੀਤਾ ਹੈ ਜਿਸ ਕਰਕੇ ਅਸੀਂ ਬਹੁਤ ਖੁਸ਼ ਹਾਂ